ਕੁਝ ਪੋਲਟਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਆਮ ਬਿਮਾਰੀਆਂ ਹਨ ਮੁਰਗਾ ਬੁਖਾਰ ਇਸ ਨੂੰ ਰੋਕਣ ਲਈ ਪੋਲਟਰੀ ਨੂੰ ਨਿਯਮਤ ਚੈੱਕ ਅੱਪ ਅਤੇ ਰਾਹਤ ਦੀ ਸੰਭਾਲ ਬੜੀ ਜ਼ਰੂਰੀ ਹੈ ਨਿਊ ਕਾਸ਼ਲ ਡਿਜੀਜ਼ ਇਸ ਬਿਮਾਰੀ ਨੂੰ ਰੋਕਣ ਲਈ ਵੈਕਸੀਨ ਦੀ ਸਹੀ ਸਮੇਂ 'ਤੇ ਪੋਲਟਰੀ ਨੂੰ ਵੈਕਸੀਨੇਟ ਕਰਨਾ ਬੜੀ ਜ਼ਰੂਰੀ ਹੈ ਐਵੀਅਨ ਫੈਂਕਟੀਅਸ ਦਰਾਂਕਇਟਸ ਇਸ ਨੂੰ ਰੋਕਣ ਲਈ ਪੋਲਟਰੀ ਦੀ ਸਵੱਸਥਾ ਨੂੰ ਬਰਾਬਰ ਤੌਰ 'ਤੇ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਭੋਜਨ ਅਤੇ ਪਾਣੀ ਦੀ ਸਹੀ ਪੇਸ਼ਕਸ਼ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਪੋਲਟਰੀ ਨੂੰ ਸਹੀ ਤਰੀਕੇ ਨਾਲ ਸਹੀ ਰੱਖਣ ਲਈ ਕੁਝ ਟਿੱਪਣੀਆਂ ਹਨ ਪੋਲਟਰੀ ਦੀ ਠੀਕ ਦੇਖਭਾਲ ਪੋਲਟਰੀ ਦੇ ਘਰੇਲੂ ਜਗ੍ਹਾ ਦੀ ਸਫਾਈ ਦੀ ਪੂਰੀ ਤੌਰ 'ਤੇ ਸੰਭਾਲ ਕਰਨੀ ਚਾਹੀਦੀ ਹੈ ਪੋਲਟਰੀ ਦੀ ਸਾਫ ਤਾਗੀ ਅਤੇ ਸੈਨੀਟੇਸ਼ਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਨਿਯਮਤ ਚੈੱਕ ਅਪ ਅਤੇ ਵੈਕਸੀਨ ਪੋਲਟਰੀ ਨੂੰ ਨਿਯਮਤ ਚੈੱਕ ਅਪ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਹੀ ਸਮੇਂ 'ਤੇ ਵੈਕਸੀਨੇਟ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਬਿਮਾਰੀ ਦੇ ਖਿਲਾਫ ਉਹਨਾਂ ਦੀ ਸੰਭਾਲ ਹੋ ਸਕੇ ਉਚਿਤ ਖੁਰਾਕ ਪੇਸ਼ਕਸ਼ ਪੋਲਟਰੀ ਨੂੰ ਉਚਿਤ ਖੁਰਾਕ ਅਤੇ ਪਾਣੀ ਦੀ ਸੁਰੱਖਿਅਤ ਪੇਸ਼ਕਸ਼ ਕਰਨੀ ਚਾਹੀਦੀ ਹੈ ਉਹਨਾਂ ਨੂੰ ਉਚਿਤ ਪੋਸ਼ਣ ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੀ ਸਿਹਤ ਅਤੇ ਪ੍ਰਦਰਸ਼ਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਸੁਰੱਖਿਅਤ ਉਪਕਰਨ ਦੀ ਵਰਤੋਂ ਪੋਲਟਰੀ ਨੂੰ ਅਤੇ ਸੁਰੱਖਿਅਤ ਉਪਕਰਨ ਦੀ ਵਰਤੋਂ ਕਰਕੇ ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਜਿਵੇਂ ਕਿ ਵਿਊਮਨ ਦੇਖਭਾਲ ਦੀ ਪ੍ਰਕਿਰਿਆ ਵਗੈਰਾ ਇਹ ਸਾਰੇ ਤਰੀਕੇ ਪੋਲਟਰੀ ਦੀ ਸਹੀ ਸਿਹਤਮੰਦੀ ਨੂੰ ਸੁਰੱਖਿਅਤ ਰੱਖਣ ਲਈ ਹੈ ਇਸ ਤਰ੍ਹਾਂ ਉਹ ਬਿਮਾਰੀਆਂ ਦੀ ਭਾਲ ਅਤੇ ਪ੍ਰੋਫਾਇਲ ਲੈਕਟਿਵ ਮਸੂਏਟਾਂ ਤੋਂ ਬਚਣ ਲਈ ਤਿਆਰ ਹੁੰਦੇ ਹਨ